ਹੈਲੋ ਹਾਂਜੀ ਸਤਿ ਸ਼੍ਰੀ ਕਾਲ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਤੁਹਾਨੂੰ ਕਿਵੇਂ ਦਾ ਮੈਮ ਚਾਹੀਦਾ ਹੇਅਰਸਟਾਈਲ ਵਗੈਰਾ ਅੱਛਾ ਜੀ ਮੈਮ ਮੈਂ ਤੁਹਾਨੂੰ ਦੱਸਾਂ ਕਿ ਸਾਡੇ ਅੱਗੇ ਹੁਣ ਨਿਊ ਯਿਅਰ ਆ ਰਿਹਾ ਜਿਵੇਂ ਕਿ ਔਫਰ ਚੱਲਦੀਆਂ ਪਈਆਂ ਨੇ ਤੁਹਾਡੀ ਹੇਅਰ ਲੈਂਥ ਕਿੰਨੀ ਆ ਅੱਛਾ ਜੀ ਹਾਂਜੀ ਤੁਸੀਂ ਮੈਨੂੰ ਇੱਕ ਵਾਰੀ ਮਿਲ ਵੀ ਲਿਓ ਨੈਕਸਟ ਮੰਥ ਅਤੇ ਹੁਣ ਜਿਦਾਂ ਹੁਣ ਅੱਗੇ ਨਿਊ ਯਿਅਰ ਆ ਰਿਹਾ ਉਹਦੇ ਲਈ ਪੈਕਜ ਚਲਦੇ ਪਏ ਆ ਅਤੇ ਤੁਸੀਂ ਆ ਕੇ ਇੱਕ ਵਾਰੀ ਮੇਰੇ ਇੱਥੇ ਵਿਜਿਟ ਕਰ ਲਓ ਔਫਰ ਵਗੈਰਾ ਚੱਲਦੇ ਪਏ ਆ ਜਿਵੇਂ ਤੁਹਾਡੀ ਲੈਂਥ ਸ਼ੋਲਡਰ ਤੱਕ ਏ ਆ ਇਹਦੇ ਲਈ ਤੁਹਾਨੂੰ ਵੈਸੇ ਥਰੀ ਹੰਡਡ ਥਰੀ ਥਾਊਜ਼ੈਂਡ ਹੁੰਦਾ ਹੈ ਤੁਹਾਨੂੰ ਇਹਦੇ 'ਚ ਥੋੜ੍ਹੀ ਸ਼ੋਰਟੇਜ ਮਿਲਜੇਗੀ

ਓਕੇ ਮੈਮ ਫਿਰ ਤੁਸੀਂ ਕਦੋਂ ਵਿਜਿਟ ਕਰੋਗੇ ਮੈਮ ਸਾਡੀ ਓਪਨ ਹੋ ਜਾਂਦਾ ਟੈੱਨ ਕਲੋਕ ਹੋ ਜਾਂਦਾ ਸਵੇਰੇ

ਮੈਮ ਸ਼ਾਮੀ ਅੱਠ ਵਜੇ ਤੱਕ ਨਹੀਂ ਮੈਮ ਹੁੰਦੀ ਆ ਮੈਂ ਵੀ ਉਥੇ ਹੁੰਦੀ ਹਾਂ ਹਾਂਜੀ ਕੋਈ ਗੱਲ ਨਹੀਂ ਮੈਮ ਤੁਸੀਂ ਆ ਜਿਓ ਕਦੋਂ ਵਿਜਿਟ ਕਰ ਲਿਓ ਠੀਕ ਹੈ ਮੈਮ ਠੀਕ ਹੈ ਜੀ ਓਕੇ